ਬਿਲਕੁਲ ਜੀ ਸਾਡੇ ਕੋਲ ਪੰਜਾਬੀ ਕਹਾਵਤਾਂ ਜਾਂ ਮੁਹਾਵਰੇ ਹਨ ਅਤੇ ਇਹਨਾਂ ਵਿੱਚੋਂ ਵਿਸ਼ੇਸ਼ ਤੌਰ 'ਤੇ ਜਿਵੇਂ ਹੱਥ ਨਾ ਪਹੁੰਚੇ ਥੂ ਕੌੜੀ ਇਹਦੇ ਵਿੱਚ ਇਹ ਹੈ ਵੀ ਜਦੋਂ ਸਾਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੁੰਦੀ ਤਾਂ ਫੇਰ ਅਸੀਂ ਉਹਨੂੰ ਦਿਕਾਰਨਾ ਸ਼ੁਰੂ ਕਰ ਦਿੰਦੇ ਹਾਂ ਅਤੇ ਇੱਕ ਕਹਾਵਤ ਹੈ ਅੰਨ੍ਹਾ ਮਾਰੇ ਅੰਨ੍ਹੀ ਨੂੰ ਅਤੇ ਘਸੁੰਨ ਵੱਜੇ ਥੰਮ੍ਹੀ ਨੂੰ ਮਤਲਬ ਜਦੋਂ ਕੋਈ ਦੋ ਵਿਅਕਤੀ ਆਪਸ ਵਿੱਚ ਬਿਨਾ ਕਿਸੇ ਵਜ੍ਹਾ ਦੇ ਬਿਨਾ ਕਿਸੇ ਗੱਲ ਦੇ ਬਿਨਾ ਕਿਸੇ ਮੂੰਹ ਸਿਰ ਦੇ ਜਦੋਂ ਆਪਸ ਵਿੱਚ ਲੜਾਈ ਕਰਦੇ ਹਨ ਤਾਂ ਕੋਈ ਵੀ ਗੱਲ ਕੋਈ ਵੀ ਕਿਵੇਂ ਵੀ ਕੋਈ ਕਿਸੇ ਨੂੰ ਕੁਛ ਕਹਿ ਦਿੰਦਾ ਅਤੇ ਜਿਹਦਾ ਕੋਈ ਮੂੰਹ ਸਿਰ ਨਹੀਂ ਹੁੰਦਾ ਉੱਥੇ ਵੀ ਇਹ ਕਹਾਵਤ ਵਰਤੀ ਜਾਂਦੀ ਹੈ ਅਤੇ ਗੱਲੀ ਬਾਤੀਂ ਮੈਂ ਵੱਡੀ ਅਤੇ ਕਰਤੂਤੀ ਵੱਡੀ ਜੇਠਾਣੀ ਇਹਦੇ ਵਿੱਚ ਇਹ ਆ ਕਿ ਥਰੈਟੀਕਲੀ ਕੁਝ ਕੰਮ ਕਰਦੇ ਹਾਂ ਅਸੀਂ ਅਤੇ ਕੁਝ ਹੁੰਦਾ ਅਸੀਂ ਪ੍ਰੈਕਟੀਕਲੀ ਕੰਮ ਕਰਦੇ ਹਾਂ ਤਾਂ ਉਹਦੇ ਵਿੱਚ ਇਹੀ ਹੈ ਵੀ ਕੁਝ ਲੋਕ ਸਿਰਫ ਥਰੈਟਿਕਲੀ ਗੱਲਾਂ ਬਾਤਾਂ ਵਾਲੇ ਹੁੰਦੇ ਹੈ ਅਤੇ ਘਰ ਦੇ ਵਿੱਚ ਵੀ ਜਿਵੇਂ ਆਮ ਕਿਹਾ ਗਿਆ ਵੀ ਗੱਲੀ ਬਾਤੀਂ ਮੈਂ ਵੱਡੀ ਵੀ ਜੇ ਤਾਂ ਗੱਲਾਂ ਗੁੱਲਾਂ ਕਰਵਾਉਣੀਆਂ ਤਾਂ ਮੇਰੇ ਤੋਂ ਕਰਵਾ ਲਓ ਪਰ ਹਾਂ ਜੇ ਕੰਮ ਕਰਵਾਉਣਾ ਹੋਇਆ ਤਾਂ ਉਹ ਜਿਹੜਾ ਕੰਮ ਆ ਉਹ ਕਰੇਗੀ ਜੇਠਾਣੀ ਅਤੇ ਇਹਦੇ ਵਿੱਚ ਇੱਕ ਇਹ ਵੀ ਆ ਵੀ ਵਾਰਿਸ ਸ਼ਾਹ ਆਦਤਾਂ ਨਾ ਜਾਂਦੀਆਂ ਨੇ ਅਤੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ ਇਹਦੇ ਵਿੱਚ ਕੀ ਇੱਕ ਜੀਵਨ ਸੱਚਾਈ ਨੂੰ ਜਿਹੜਾ ਪੇਸ਼ ਕੀਤਾ ਗਿਆ ਕਿ ਵਾਰਿਸ ਸ਼ਾਹ ਕਹਿ ਰਿਹਾ ਕਿ ਮਨੁੱਖ ਦੀਆਂ ਜਿਹੜੀਆਂ ਆਦਤਾਂ ਨੇ ਉਹ ਜਾਂਦੀਆਂ ਨਹੀਂ ਹੈ ਭਾਵੇਂ ਤੁਸੀਂ ਉਹਦੇ ਲਈ ਜਿੰਨਾ ਮਰਜ਼ੀ ਉਹਨੂੰ ਡਾਂਟ ਲਓ ਫਿਟਕਾਰ ਲਓ ਅਤੇ ਵਾਰਿਸ ਸ਼ਾਹ ਲੁਕਾਈਏ ਜੱਗ ਕੋਲੋਂ ਅਤੇ ਭਾਵੇਂ ਆਪਣਾ ਹੀ ਗੁੜ ਖਾਈਏ ਜੀ ਵਾਰਿਸ ਸ਼ਾਹ ਇੱਥੇ ਇਸ਼ਕ ਦੀ ਗੱਲ ਵੀ ਕਰ ਰਿਹਾ ਉਹ ਕਹਿੰਦਾ ਵੀ ਇਸ਼ਕ ਮੁਸ਼ਕ ਆ ਜਿਹੜੇ ਲੁਕਾਇਆ ਛੁਪਦੇ ਨਹੀਂ ਹੈ ਉਹ ਤਾਂ ਦੁ ਲੋਕਾਂ ਤੋਂ ਛੁਪਾ ਕੇ ਤੁਹਾਨੂੰ ਇਹ ਰਿਸ਼ਤਿਆਂ ਨੂੰ ਜਿਹੜਾ ਰੱਖਣਾ ਚਾਹੀਦਾ ਬਹੁਤ ਧੰਨਵਾਦ